ਸਾਡਾ ਖੇਤਰ ਸ਼ਹਿਰ ਕਪੂਰਥਲਾ ਆ ਤਕਰੀਬਨ ਇਹਦੇ ਨਾਲ ਜਿੰਨੇ ਵੀ ਪਿੰਡ ਲੱਗਦੇ ਆ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਸ ਸਟੇਡੀਅਮ ਖੇਡ ਸਟੇਡੀਅਮ ਜਿਹੜਾ ਆ ਉਹ ਤਕਰੀਬਨ ਹੈ ਹੈਗਾ ਹੀ ਆ ਜਿੱਥੇ ਕਿ ਬੱਚੇ ਜਿਹੜੇ ਆ ਸਟੂਡੈਂਟ ਜਿਹੜੇ ਆ ਜਾ ਕੇ ਆਪਣੇ ਜੋਰ ਅਜਮਾਇਸ਼ ਕਰਦੇ ਆ ਤਕਰੀਬਨ ਹਰੇਕ ਪਿੰਡ ਦੇ ਵਿੱਚ ਕਬੱਡੀ ਸਟੇਡੀਅਮ ਹੋ ਗਿਆ ਜਾਂ ਫੁਟਬਾਲ ਵਾਲੀਬਾਲ ਇਹੋ ਜਿਹੀ ਜਿਹੜੀਆਂ ਇਹ ਮੇਨ ਮੇਨ ਗੇਮਾਂ ਜਿਹੜੀਆਂ ਖੇਡੀਆਂ ਜਾਂਦੀਆਂ ਇਹ ਤੋਂ ਇਲਾਵਾ ਸ਼ਹਿਰ ਕਪੂਰਥਲਾ ਦੇ ਵਿੱਚ ਸਭ ਵੱਡਾ ਸਟੇਡੀਅਮ ਹੈ ਇਕ ਗੁਰੂ ਨਾਨਕ ਗੁਰੂ ਨਾਨਕ ਸਟੇਡੀਅਮ ਜਿਹਦੇ ਵਿੱਚ ਤਕਰੀਬਨ ਸਾਰੀਆਂ ਹੀ ਗਰਾਉਂਡਾਂ ਅਵੇਲੇਬਲ ਆ ਅਤੇ ਉੱਥੇ ਟੂਰਨਾਮੈਂਟਸ ਵੀ ਕਰਵਾਏ ਜਾਂਦੇ ਆ ਸਰਕਾਰ ਦੁਆਰਾ ਵੀ ਕਰਵਾਏ ਜਾਂਦੇ ਆ ਅਤੇ ਜਿਹੜੇ ਨਾਮਵਰ ਲੋਕ ਆ ਕਈ ਕਬੱਡੀ ਦੇ ਟੂਰਨਾਮੈਂਟ ਵੀ ਬਹੁਤ ਵੱਡੇ ਵੱਡੇ ਟੂਰਨਾਮੈਂਟ ਵੀ ਉੱਥੇ ਹੁੰਦੇ ਆ ਅਤੇ ਪਿੰਡਾਂ ਦੇ ਵਿੱਚ ਵੀ ਜਿਹੜੇ ਟੂਰਨਾਮੈਂਟ ਆ ਉਹ ਕਰਵਾਏ ਜਾਂਦੇ ਆ ਕਬੱਡੀ ਦੇ ਜਿਹਨਾਂ ਦਾ ਵਿੱਚ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕੀਤਾ ਜਾਂਦਾ ਆ ਸੋ ਇਸੇ ਤਰ੍ਹਾਂ ਸਥਾਨਕ ਲੋਕ ਜਿਹੜੇ ਆ ਲਾਗੇ ਛਾਗੇ ਦੇ ਪਿੰਡਾਂ ਦੇ ਲੋਕ ਜਿਹੜੇ ਉਹ ਵੀ ਉਹਨਾਂ ਦੀ ਵੀ ਪਹੁੰਚ ਜਿਹੜੀ ਆ ਉਹ ਪਹੁੰਚ ਸਕਦੇ ਆ ਆਰਾਮ ਦੇ ਨਾਲ ਕਿਉਂਕਿ ਸ਼ਹਿਰ ਬਾਹਲੀ ਦੂਰ ਨਹੀਂ ਆ ਲਾਗੇ ਲਾਗੇ 'ਤੇ ਪਿੰਡ ਜਿਹੜੇ ਨੇੜੇ ਆ ਵਸੋਂ ਜਿਹੜੀ ਆ ਲਾਗੇ ਲਾਗੇ ਪਿੰਡ ਤਕਰੀਬਨ ਦਸ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੀ ਹੈਗੇ ਦਸ ਪੰਦਰਾਂ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸੋ ਜਿਹੜੇ ਸਮਾਗਮ ਟੂਰਨਾਮੈਂਟਸ ਵਗੈਰਾ ਉਹ ਮੇਨ ਸਟੇਡੀਅਮ ਦੇ ਵਿੱਚ ਵੀ ਕਰਵਾਏ ਜਾਂਦੇ ਆ ਅਤੇ ਤਕਰੀਬਨ ਪਿੰਡਾਂ ਦੇ ਵਿੱਚ ਵੀ ਕਬੱਡੀ ਟੂਰਨਾਮੈਂਟ ਵਗੈਰਾ ਹੁੰਦੇ ਹੀ ਆ